ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਬੋਲ ਰਹੀ ਹਾਂ ਮੋਹਾਲੀ ਤੋਂ ਮੈਂ ਤੁਹਾਡੀ ਵੈੱਬਸਾਈਟ ਤੋਂ ਖਾਣਾ ਆਰਡਰ ਕੀਤਾ ਸੀ ਜਿਸ 'ਚ ਕਿ ਦਾਲ ਮੱਖਣੀ ਸ਼ਾਹੀ ਪਨੀਰ ਪਨੀਰ ਦੀ ਭੁਰਜੀ ਰਾਜਮਾ ਚਾਵਲ ਰਾਇਤਾ ਸਲਾਦ ਦਸ ਸਿੰਪਲ ਰੋਟੀਆਂ ਸੀ ਪੰਜ ਤੰਦੂਰੀ ਰੋਟੀਆਂ ਅਤੇ ਦਸ ਗੁਲਾਬਜਾਮਣਾ ਸੀ ਤੁਹਾਡਾ ਆਰਡਰ ਹਜੇ ਤੱਕ ਮੇਰੇ ਕੋਲ ਨਹੀਂ ਪਹੁੰਚਿਆ ਮੇਰੇ ਘਰ ਮਹਿਮਾਨਾਂ ਨੇ ਆਉਣਾ ਸੀ ਅਤੇ ਉਹ ਆ ਗਏ ਹਨ ਅਤੇ ਮੈਂ ਉਨ੍ਹਾਂ ਨੂੰ ਚਾਹ ਦੇ ਦਿੱਤੀ ਹੈ ਅਤੇ ਚਾਹ ਨਾਲ ਸਨੈਕਸ ਵਗੈਰਾ ਦੇ ਦਿੱਤੇ ਹਨ ਅਤੇ ਹੁਣ ਖਾਣੇ ਦਾ ਟਾਈਮ ਹੋ ਗਿਆ ਹੈ ਮੈਂ ਕਦੋਂ ਦਾ ਵੇਟ ਕਰ ਰਹੀ ਹਾਂ ਤੁਸੀਂ ਪੰਦਰਾਂ ਮਿੰਟ ਕਹਿ ਰਹੇ ਹੋ ਪਰ ਅੱਧੇ ਘੰਟੇ ਤੋਂ ਆਰਡਰ ਮੇਰੇ ਤੱਕ ਨਹੀਂ ਪਹੁੰਚਿਆ ਹੈ ਤੁਸੀਂ ਮੈਨੂੰ ਦੱਸ ਦਿਉ ਕਿ ਤੁਹਾਡਾ ਆਰਡਰ ਮੇਰੇ ਤੱਕ ਕਦੋਂ ਪਹੁੰਚੇਗਾ ਅਤੇ ਕਿਰਪਾ ਕਰੋ ਛੇਤੀ ਤੋਂ ਛੇਤੀ ਮੈਨੂੰ ਮੇਰਾ ਆਰਡਰ ਦੇ ਦਿਓ